ਹੈਲੋ ਵਧੀਆ ਵਧੀਆ ਤਜਿੰਦਰ ਸਿਹਾਂ ਤੂੰ ਸੁਣਾ ਕਿਵੇਂ ਆ ਬਸ ਯਾਰ ਤੈਨੂੰ ਪਤਾ ਹੀ ਆ ਪੜ੍ਹਾਈਆਂ 'ਚ ਹੁਣ ਅੱਕੇ ਫਿਰਦੇ ਹਾਂ ਮੈਂ ਤਾਂ ਐਂ ਸੋਚਦਾ ਸੀ ਵੀ ਕੋਈ ਬਿਜਨੈਸ ਸ਼ੁਰੂ ਕਰਿਆ ਜਾਵੇ ਆਪਣਾ ਨਾਲ ਸਟਾਰਟਪ ਦਾ ਇੰਨਾ ਪੜ੍ਹੀ ਵੀ ਜਾਂਦੇ ਹਾਂ ਨਾ ਹੈ ਕੁਛ ਨਹੀਂ ਅੱਗੇ ਵੀ

ਸਹੀ ਗੱਲ ਆ ਹੁਣ ਆਪਣੇ ਤੋਂ ਪਹਿਲਾਂ ਪੜ੍ਹੇ ਲਿਖਿਆ ਨੇ ਦੱਸ ਨਾ ਕੀ ਕਰਿਆ ਉਹ ਵੀ ਵਿਚਾਰੇ ਐਂ ਹੀ ਫਿਰਦੇ ਨੇ ਰੁਲਦੇ ਹਾਂ ਹਾਂ ਇਹ ਤਾਂ ਯਾਰ ਬਿਲਕੁਲ ਮੈਂ ਵੀ ਇਹ ਹੀ ਸੋਚਦਾ ਸੀ ਵੀ ਹੈ ਨਾ ਇਹੋ ਜਿਹਾ ਆਪਾਂ ਦੋਵੇਂ ਰਲ ਕੇ ਕਰ ਲਈਏ ਹਾਂ ਹੈ ਨਾ ਅੱਛਾ ਅੱਛਾ ਅੱਛਾ ਅੱਛਾ ਨਾ ਟਿਊਸ਼ਨ ਵਾਲਾ ਮੈਨੂੰ ਸੂਤ ਲੱਗਦਾ ਯਾਰ ਹੈ ਨਾ ਇਕ ਆਪਾਂ ਹਾਂ ਦੂਜਾ ਆਪਾਂ ਵੀ ਪੜ੍ਹੇ ਹਾਂ ਨਾ ਆਪਾਂ ਨੂੰ ਪਤਾ ਵੀ ਕਿਵੇਂ ਟ੍ਰੀਟ ਕਰਨਾ ਜਵਾਕਾਂ ਨਾਲ ਹਾਂ ਨਾਲੇ ਆਪਣੇ ਜਗ੍ਹਾ ਜੁਗਾ ਦਾ ਚਲ ਆਪਾਂ ਕਰ ਲਾਂਗੇ ਉਰੇ ਹੈਗੇ ਨੇ ਆਪਣੇ ਯਾਰ ਬੇਲੀ ਉੱਥੇ ਮਿਲ ਜੂ ਆਪਾਂ ਨੂੰ ਜਗ੍ਹਾ ਦਾ ਖੋਲ੍ਹਣ ਲਈ ਵੀ ਹਾਂ ਇੱਥੇ ਮਿਲ ਜੂ ਆਪਾਂ ਨੂੰ ਖਾਲਸਾ ਕੋਲਜ ਦੇ ਨੇੜੇ ਮਿਲ ਜੂਗੀ ਹਾਂ ਹਾਂ ਆਪਣੇ ਵਾਧੂ ਯਾਰ ਦੋਸਤ ਨੇ ਉੱਥੇ ਵਾਧੂ ਮਿਲ ਜਾਣੀ ਹੈ ਆਪਾਂ ਨੂੰ ਜਗ੍ਹਾ ਤਾਂ ਨਾਲੇ ਰੋਡ 'ਤੇ ਹੋਜੂਗੀ ਮੇਨ ਰੋਡ 'ਤੇ ਨਾ ਅਤੇ ਥੋੜ੍ਹਾ ਜਿਹਾ ਅਰਬਨ ਜਿਹਾ ਏਰੀਆ ਆਪਾਂ ਨੂੰ ਇਹ ਫਾਇਦਾ ਹੋਜੂ ਹਾਂਜੀ ਹਾਂ ਮੈਂ ਮੈਂ ਤਾਂ ਹੀ ਤੈਨੂੰ ਫੋਨ ਕਰਿਆ ਸੀ ਮੈਂ ਕਿਹਾ ਇੱਕ ਵਾਰੀ ਗੱਲ ਕਰ ਲਈਏ ਆਪਾਂ ਜੇ ਦੋਹਾਂ ਦਾ ਆਪਣਾ ਠੀਕ ਆ ਫਿਰ ਆਪਾਂ ਉੱਧਰ ਕਰ ਲਾਂਗੇ ਨਾ ਫਿਰ ਤਾਂ ਅੱਗੇ ਵਧੇਦਾ ਫਾਇਦਾ ਆਪਾਂ ਨੂੰ ਹਾਂ ਹੋਰ ਤੂੰ ਸੁਣਾ ਘਰੇ ਕਿਵੇਂ ਨੇ ਬਾ ਯਾਰ ਹਾਂ ਹਾਂ ਹਾਂ ਹਾਂ ਹਾਂ ਹਾਂ ਨਾਲੇ ਚਾਹ ਪਾਣੀ ਪੀਵਾਂਗੇ ਇੰਨਾ ਟਾਈਮ ਹੋ ਗਿਆ ਮਿਲੇ ਵੀ ਨਹੀਂ ਆਪਾਂ ਤਾਂ ਹਾਂ ਮੇਰਾ ਭਰਾ ਓਕੇ